ਹੈਲੋ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਸਰ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਜਿੱਦਾਂ ਕਿ ਟੈਲੀਵਿਜ਼ਨ ਤੋਂ ਤੁਹਾਡਾ ਮਨਪਸੰਦ ਸੋਅ ਕਿਹੜਾ ਹੈ ਅਤੇ ਕਿਉਂ ਦਰਅਸਲ ਮੈਨੂੰ ਟੈਲੀਵਿਜ਼ਨ ਦੇਖਣ ਦਾ ਕੋਈ ਸ਼ੌਕ ਨਹੀਂ ਅਗਰ ਸ਼ੌਕ ਹੈ ਤਾਂ ਮੈਨੂੰ ਆਪਣੀਆਂ ਹਿੰਦੂ ਧਰਮ ਦੀਆਂ ਧਾਰਮਿਕ ਜਿੱਦਾਂ ਰਾਮਾਇਣ ਮਹਾਂਭਾਰਤ ਸ਼੍ਰੀ ਕ੍ਰਿਸ਼ਨਾ ਇੱਦਾਂ ਦੇ ਸੀਰੀਅਲ ਨਾਟਕ ਦੇਖਣ ਦਾ ਬਹੁਤ ਸ਼ੌਕ ਹੈ ਜੋ ਕਿ ਸਾਡੇ ਹਿੰਦੂ ਧਰਮ ਨੂੰ ਹਿੰਦੂ ਧਰਮ ਨੂੰ ਦਰਸਾਉਂਦਾ ਹੈ ਸਾਡੀ ਇਹ ਚੀਜ਼ਾਂ ਦੇਖਣ ਨਾਲ ਸਾਡੇ ਵਿੱਚ ਬੜਾ ਹੀ ਸੁਧਾਰ ਹੁੰਦਾ ਹੈ ਇੱਕ ਤਾਂ ਇਸ ਵਿੱਚੋਂ ਅੱਛੀ ਸ਼ਿਕਸ਼ਾ ਮਿਲਦੀ ਹੈ ਨਾ ਕਿ ਕੋਈ ਮਾੜੀ ਠੀਕ ਹੈ ਇਸ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਕਿੱਦਾਂ ਕਿੱਦਾਂ ਕਿੱਦਾਂ ਕਿੱਦਾਂ ਕਿਸੇ ਨਾਲ ਰਹਿਣਾ ਚਾਹੀਦਾ ਹੈ ਅਤੇ ਘਰ ਪਰਿਵਾਰ ਨੂੰ ਕਿਸ ਤਰ੍ਹਾਂ ਨਾਲ ਜੋੜ ਕੇ ਰੱਖਦਾ ਹੈ ਸਾਨੂੰ ਆਪਸ ਵਿੱਚ ਪ੍ਰੇਮ ਭਾਵ ਨਾਲ ਰਹਿਣਾ ਦਰਸਾਉਂਦਾ ਹੈ ਨਾਲ ਕਿ ਸਾਨੂੰ ਦੱਸਦਾ ਹੈ ਕਿ ਮਾੜੇ ਕੰਮ ਨਹੀਂ ਕਰਨੇ ਚਾਹੀਦੇ ਇਸ ਤਰ੍ਹਾਂ ਦੀਆਂ ਸਾਨੂੰ ਇਸ ਸੀਰਲ ਸੀਰੀਅਲ ਜਿੱਦਾਂ ਕਿ ਰਮਾਇਣ ਮਹਾਂਭਾਰਤ ਸ਼੍ਰੀ ਕ੍ਰਿਸ਼ਨ ਦੇਖਣ ਨਾਲ ਸਾਨੂੰ ਮਿਲਦਾ ਹੈ ਸਾਨੂੰ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੀਦਾ ਸਾਨੂੰ ਇੱਦਾਂ ਦੀਆਂ ਅੱਛੀ ਅੱਛੀ ਆਦਤਾਂ ਦੇਖਣ ਨੂੰ ਮਿਲਦੀਆਂ ਹਨ